ਪੰਜਾਬੀ ਭਾਸ਼ਾ ਨੂੰ ਓਨਾ ਉੱਚਾ ਪੱਧਰ ਨਹੀਂ ਦਿੱਤਾ ਜਾਂਦਾ ਹੈ ਜਿੰਨਾ ਕਿ ਅੱਜ ਕੱਲ੍ਹ ਦੇਣਾ ਚਾਹੀਦਾ ਹੈ ਇ ਇਹ ਵੀ ਕਿ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਦਾ ਪੱਧਰ ਘੱਟਦਾ ਜਾ ਰਿਹਾ ਹੈ ਲੋਕ ਅੰਗਰੇਜ਼ੀ ਵੱਲ ਜ਼ਿ ਜ਼ਿਆਦਾ ਤੁਰਦੇ ਜਾ ਰਹੇ ਹਨ ਅਤੇ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਅਗਰ ਤੁਸੀਂ ਕਨੇਡਾ ਵਿੱਚ ਜਾਉਂਗੇ ਤਾਂ ਜ਼ਿਆਦਾਤਰ ਤੁਹਾਨੂੰ ਲੋਕ ਉੱਥੇ ਪੰਜਾਬੀ ਬੋਲਦੇ ਹੀ ਨਜ਼ਰ ਆਉਣਗੇ ਕਿਉਂਕਿ ਉੱਥੇ ਪੰਜਾਬੀਆਂ ਦਾ ਇੰਨਾ ਬੋਲਬਾਲਾ ਹੋ ਚੁੱਕਾ ਹੈ ਇੱਥੇ ਪੰਜਾਬ ਵਿੱਚ ਹੀ ਅਸੀਂ ਪ ਪੰਜਾਬੀ ਛੱਡ ਕੇ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਪੱਧਰ ਦੇ ਰਹੇ ਹਾਂ ਉਸ ਨੂੰ ਅੱਗੇ ਵਧਾ ਰਹੇ ਹਾਂ ਅਤੇ ਸਾਡੀ ਪੰਜਾਬੀ ਘੱਟਦੀ ਜਾ ਰਹੀ ਹੈ ਬੱਚਿਆਂ ਨੂੰ ਵੀ ਨਿੱਕਿਆਂ ਨਿੱਕਿਆਂ ਨੂੰ ਅਸੀਂ ਅੰਗਰੇਜ਼ੀ ਸਿਖਾਉਣਾ ਹੀ ਸ਼ੁਰੂ ਕਰਦੇ ਹਾਂ ਜਦਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਸਿਖਾਉਣੀ ਚਾਹੀਦੀ ਹੈ ਜੇਕਰ ਕੋਈ ਪੰਜਾਬ ਦਾ ਬੰਦਾ ਕਿਸੇ ਹੋਰ ਵ ਵਿਅਕਤੀ ਨਾਲ ਗੱਲ ਕਰਦਾ ਹੈ ਤਾਂ ਉਹ ਬੜੇ ਹੀ ਜਲਦੀ ਹਿੰਦੀ 'ਤੇ ਉੱਤਰ ਆਉਂਦਾ ਹੈ ਇਹ ਨਹੀਂ ਕਿ ਆਪਣੀ ਪੰਜਾਬੀ ਵਿੱਚ ਹੀ ਰਹੇ ਰਹੇ ਪੰਜਾਬੀ ਦਾ ਬੋਲਬਾਲਾ ਤਾਂ ਪੰਜਾਬੀ ਗਾਣਿਆਂ ਨੇ ਬਹੁਤ ਵਧਾਇਆ ਹੋਇਆ ਹੈ ਸਾਰੇ ਭਾਰਤ ਵਿੱਚ ਹੀ ਪੰਜਾਬੀ ਗਾਣੇ ਸੁਣੇ ਜਾਂਦੇ ਹਨ ਅਤੇ ਬਹੁਤ ਹੀ ਪ੍ਰਚੱਲਿਤ ਹਨ ਕੋਈ ਮੈਂ ਪਿੱਛੇ ਜਿਹੇ ਇੱਕ ਵਿਆਹ ਵਿੱਚ ਗਿਆ ਸੀ ਜੋ ਕਿ ਸਾਊਥ ਦਾ ਬੰਦਾ ਸੀ ਉਹ ਵੀ ਪੰਜਾਬੀ ਗਾਣਿਆਂ ਉੱਤੇ ਝੂਮ ਰਹੇ ਸਨ ਅਤੇ ਬਲਕਿ ਉਹਨਾਂ ਨੂੰ ਇੱਕ ਵੀ ਪੰਜਾਬੀ ਦਾ ਸ਼ਬਦ ਸਮਝ ਨਹੀਂ ਆ ਰਿਹਾ ਸੀ ਬਟ ਪਰ ਉਹ ਫਿਰ ਵੀ ਬਹੁਤ ਪਸੰਦ ਕਰ ਰਹੇ ਸਨ ਉਸ ਪੰਜਾਬੀ ਗਾਣੇ ਨੂੰ